ਹੈਲੋ

ਹੈਲੋ ਹਾਂਜੀ ਹਾਂਜੀ ਸਾਡੀ ਲੱਸੀ ਦੀ ਸ਼ੋਪ ਆ ਹਾਂਜੀ ਹਾਂਜੀ ਹਾਂਜੀ ਸਰ ਸਭ ਤਰ੍ਹਾਂ ਦੀ ਲੱਸੀ ਮਿਲਦੀ ਹੈ ਇੱਥੋਂ ਖੱਟੀ ਲੱਸੀ ਮਿੱਠੀ ਮਲਾਈ ਵਾਲੀ ਹਾਂਜੀ ਹੋਰ ਜੀਰੇ ਵਾਲੀ ਜੀਰੇ ਵਾਲੀ ਹਾਂ ਹਾਂਜੀ ਪੁਦੀਨੇ ਵਾਲੀ ਵੀ ਹੈ ਲੱਸੀ ਅਸੀਂ ਆਪ ਖੁਦ ਬਣਾਉਂਦੇ ਹਾਂ ਹਾਂਜੀ ਦਹੀਂ ਬਣਾ ਕੇ ਹਾਂਜੀ ਦੋਵੇਂ ਤਰ੍ਹਾਂ ਦੀ ਹੈ ਮੱਝ ਦੀ ਵੀ ਹੈ ਗੋਪੀ ਤਰ੍ਹਾਂ ਦੀ ਹਾਂਜੀ ਮੱਝ ਦੀ ਹਾਂਜੀ ਜ਼ਿਆਦਾਤਰ ਗੋਕੀ ਹੁੰਦੀ ਹੈ ਲੱਸੀ ਹਾਂਜੀ ਹਾਂਜੀ ਇਹ ਲੋਕ ਇਹ ਪਸੰਦ ਕਰਦੇ ਹੈ ਕਿਉਂਕਿ ਲੋਕ ਇਹ ਪਸੰਦ ਕਰਦੇ ਹਨ

ਹਾਂਜੀ ਅਸੀਂ ਉਹ ਮਿਕਸੀ ਹੈ ਚਾਟੀ ਚਾਟੀ ਵਾਲੀ ਮਿਕਸੀ ਹੈ ਹਾਂਜੀ ਹਾਂਜੀ ਉਹਦੇ 'ਚ ਰਿੜਕਦੇ ਹਾਂ ਚਾਟੀ ਵਾਲੀ ਹਾਂਜੀ ਚਾਟੀ ਵਾਲੀ ਮਿਕਸੀ 'ਚ ਰਿੜਕਦੇ ਹਾਂ ਹਾਂਜੀ ਹਾਂਜੀ ਹਾਂਜੀ ਮਿੱਠੀ ਦੇ ਹੈਗਾ ਚਾਲੀ ਰੁਪਏ ਹਾਂਜੀ ਨਮਕ ਵਾਲੀ ਤੀਹ ਰੁਪਏ ਦਾ ਮਿੱਠੀ ਕਿਉਂਕਿ ਚੀਨੀ ਦੇ ਰੇਟ ਵਧੇ ਹੋਏ ਹੈ ਇਹ ਤੀਹ ਹਾਂਜੀ ਚਾਲੀ ਰੁਪਏ ਦਾ ਹੈ ਹਾਂਜੀ ਚਾਲੀ ਜੀਰੇ ਜੀਰੇ ਵਾਲਾ ਵੀ ਚਾਲੀ ਰੁਪਏ ਦਾ ਪੁਦੀਨੇ ਵਾਲੇ ਦਾ ਵੀ ਤੀਹ ਰੁਪਏ ਹਾਂਜੀ ਅਲੱਗ ਅਲੱਗ ਰੇਟ ਹੈ ਹਾਂਜੀ ਹਾਂ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਪੂਰਾ ਹਾਂਜੀ ਘਰ ਵੀ ਲਿਜਾ ਸਕਦੇ ਆ ਤੁਸੀਂ ਹਾਂਜੀ ਘਰ ਵੀ ਲਿਜਾ ਸਕਦੇ ਠੰਢੀ ਵੀ ਮਿਲੇਗੀ ਥੋੜ੍ਹੀ ਜਿਹੀ ਤਾਜ਼ੀ ਵੀ ਮਿਲੇਗੀ ਠੰਢੀ ਵੀ ਮਿਲੇਗੀ ਹਾਂਜੀ ਮਲਾਈ ਵਾਲੀ ਵੀ ਮਿਲੇਗੀ ਸਿੰਪਲ ਵੀ ਮਿਲ ਜਾਂਦੀ ਆ ਹਾਂਜੀ ਸਾਦੀ ਵੀ ਹਾਂਜੀ ਮਿੱਠੀ ਲੱਸੀ ਅਸੀਂ ਜਿਵੇਂ ਹੀ ਕਸਟਮਰ ਹੀ ਮੰਗੇ ਹਾਂਜੀ ਹਾਂਜੀ ਜਿਵੇਂ ਇੱਕ ਹਾਂਜੀ ਜਿਵੇਂ ਉਹ ਕਸਟਮਰ ਮੰਗਦਾ ਨਾ ਉਸ ਤਰ੍ਹਾਂ ਹੀ ਬਣਾ ਦਿੰਦੇ ਜੇ ਕਹਿਣ ਮਲਾਈ ਵਾਲੀ ਤਾਂ ਮਲਾਈ ਵਾਲੀ ਬਣਾ ਦਿੰਦੇ ਜੇ ਸਿੰਪਲ ਦਹੀਂ ਵਾਲੀ ਵੀ ਲੈਣੀ ਆ ਇਕੱਲੀ ਤਾਂ ਦਹੀਂ ਵਾਲੀ ਬਣਾ ਦਿੰਦੇ ਆ ਹਾਂਜੀ ਹਾਂਜੀ ਨਹੀਂ ਕਿੰਨਾ ਹਾਂ ਅੱਧਾ ਕਿੱਲੋ ਕਿੱਲੋ ਇਸ ਤੋਂ ਘੱਟ ਤਾਂ ਨਹੀਂ ਬਣਦੇ ਕਿੱਲੋ ਲੈ ਜਾਂਦੇ ਆ ਕੋਈ ਅੱਧਾ ਕਿੱਲੋ ਲੈ ਜਾਂਦੇ ਆ ਇਸ ਤੋਂ ਘੱਟ ਤਾਂ ਨਹੀਂ ਕੋਈ ਪੀਦਾ ਗਲਾਸ ਪੂਰਾ ਗਿਲਾਸ ਅੱਧਾ ਕਿੱਲੋ ਵਾਲਾ ਹੀ ਹੈ ਹਾਂਜੀ ਹਾਂਜੀ ਹਾਂਜੀ ਜਿੰਨੀ ਹਾਂਜੀ ਜਿੰਨੀ ਕਸਟਮਰ ਕਹੇ ਹਾਂਜੀ ਹਾਂਜੀ ਜਿੰਨੀ ਕਸਟਮਰ ਮੰਗੇ ਤਾਂ ਵੈਸੇ ਤਾਂ ਕਿੱਲੋ ਵੀ ਲੈ ਲੈਂਦੇ ਜ਼ਿਆਦਾ ਤਾਂ ਅੱਧਾ ਕਿੱਲੋ ਵੀ ਲੈ ਲੈਂਦੇ ਜਾਂ ਇਸ ਤੋਂ ਘੱਟ ਤਾਂ ਨਹੀਂ ਲੈਂਦੇ ਹਾਂਜੀ ਕੋਈ ਹੁੰਦਾ ਕੋਈ ਕਸਟਮਰ ਹੁੰਦਾ ਕਿ ਜਿਹੜਾ ਕਹਿ ਦਿੰਦੇ ਛੋਟਾ ਗਿਲਾਸ ਦਓ ਹਾਂਜੀ ਬੱਚੇ ਜੇ ਬੱਚਾ ਕੋਈ ਸਰ ਨਾਲ ਹੋਵੇ ਉਹਨਾਂ ਦੇ ਹਾਂਜੀ ਹਾਂ ਹਾਂਜੀ ਨਮਕ ਵਾਲੀ ਪੈਕ ਕਰ ਦਿੰਦੇ ਹਾਂ ਨਮਕ ਵਾਲੀ ਪੈਕ ਕਰਨੇ ਮਿੱਠੀ ਵੀ ਪੈਕ ਕਰ ਦਿੰਦੇ ਹਾਂ ਹਾਂਜੀ ਹਾਂਜੀ ਹਾਂਜੀ ਗੋਕੀ ਹੈ ਹਾਂਜੀ ਲੱਸੀ ਗੋਕੀ ਹੈ ਗੋਕੀ ਵੀ ਹੈ ਮੱਝ ਵੀ ਹੈ ਹਾਂਜੀ ਮੱਝ ਦੀ ਵੀ ਹੈ ਦੋਨੋਂ ਤਰ੍ਹਾਂ ਦੀ ਹਾਂਜੀ

ਹਾਂਜੀ ਉਹ ਥੋੜ੍ਹਾ ਜਿਹਾ ਗੋਕੀ ਦਾ ਵਿੱਚ ਪੀਲਾਪਨ ਥੋੜ੍ਹਾ ਜਿਹਾ ਆਉਂਦਾ ਕੇਸਰ ਪੀਨਾ ਹਾਂਜੀ ਅਤੇ ਮੱਝ ਦਵਾਈ ਸੈਦ ਸੈਦ ਹਾਂਜੀ ਮੱਝ ਦਾ ਸੈਦ ਹੁੰਦਾ ਹਾਂਜੀ ਹਾਂਜੀ ਮੱਝ ਦਾ ਸੈਦ ਹਾਂਜੀ ਹਾਂਜੀ ਹਾਂ ਕਿਸੇ ਵੀ ਬਣਾ ਲਓ ਹਾਂ ਪੀਣ 'ਚ ਟੇਸਟੀ ਹੁੰਦੀ ਹੈ ਹਾਂਜੀ ਪੀਣ ਵਿੱਚ ਟੇਸਟੀ ਹੁੰਦੀ ਆ ਤੁਹਾਨੂੰ ਪੀ ਕੇ ਦੇਖੋ ਜੇ ਤੁਸੀਂ ਤੁਹਾਨੂੰ ਲੱਗੇ ਅਤੇ ਤੁਸੀਂ ਸਾਡੇ ਕੋਲੋਂ ਰੋਜ਼ ਹੀ ਆ ਕੇ ਲਿਆ ਕਰੋਗੇ ਹਾਂਜੀ ਹਾਂ ਹਾਂਜੀ ਜ਼ਰੂਰ ਸਾਡੀ ਸ਼ੋਪ 'ਤੇ ਆਓ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਮਿਲ ਜਾਂਦੀ ਆ ਹਾਂਜੀ ਅਸੀਂ ਤਾਂ ਹਾਂਜੀ ਵੱਧ ਮਾਤਰਾ 'ਚ ਦਹੀਂ ਬਣਾਉਂਦੇ ਹਾਂ ਹਾਂਜੀ ਰੋਜ਼ ਹਾਂਜੀ ਹਾਂਜੀ ਜਿੰਨੀ ਚਾਹੀਦੀ ਉਨੀ ਮਿਲ ਸਕਦੀ